ਹੈਲੋ ਹਾਂਜੀ ਮੈਂ ਅਸੀਂ ਨਾ ਕੈਨੇਡਾ ਜਾਣਾ ਸੀ ਉਹਦੇ ਬਾਰੇ ਅਸੀਂ ਤੁਹਾਡੇ ਕੋਲ ਥੋੜ੍ਹੀ ਜਿਹੀ ਰਿਕਆਇਰਮੈਂਟ ਪੁੱਛਣੀ ਸੀ ਮੈਂ ਸਟੱਡੀ ਵੀਜ਼ੇ 'ਤੇ ਜਾਣਾ ਚਾਹੁੰਦੀ ਹਾਂ

ਅੱਛਾ

ਅਤੇ ਕਿੰਨਾ ਕੁ ਖਰਚਾ ਹੋ ਜਾਂਦਾ ਉਹਦੇ ਵਿੱਚ ਅੱਛਾ ਅੱਛਾ ਅੱਛਾ ਠੀਕ ਹੈ ਅਤੇ ਬਾਕੀ ਇਹ ਸਰਵਿਸ ਉਹਨਾਂ ਦੀ ਚੰਗੀ ਹੈ ਜਿਹਨਾਂ ਦੇ ਥਰੂ ਅਸੀਂ ਜਾਣਾ ਅੱਛਾ ਅੱਛਾ ਆਈਲੈਟਸ ਦੀ ਸਟੱਡੀ ਮੈਂ ਆਈਲੈਟਸ ਦੀ ਸਟੱਡੀ ਜਿਹੜੀ ਕਰਵਾਉਣੀ ਉਹਨਾਂ ਨੇ ਉਹ ਮਤਲਬ ਕਿ ਚੰਗੀ ਕਰਵਾਉਣਗੇ ਕੀ ਵਧੀਆ ਰਹੇਗੀ ਠੀਕ ਹੈ ਓਕੇ ਜੀ ਬਾਏ